ਕੁਝ ਆਮ ਚੁਣੌਤੀਆਂ ਜਾਂ ਸਮੱਸਿਆਵਾਂ ਹਨ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਕਾਂ ਨੂੰ ਰੋਜ਼ਾਨਾ ਦੇ ਆਧਾਰ 'ਤੇ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਵਿੱਚ ਇੱਕ ਹੈਗੀ ਹੈ ਪਾਣੀ ਦੀ ਸਮੱਸਿਆ ਪਾਣੀ ਦੀ ਸਮੱਸਿਆ ਇੰਨੀ ਜ਼ਿਆਦਾ ਵੱਧ ਚੁੱਕੀ ਹੋਈ ਹੈ ਕਈ ਵਾਰੀ ਤਾਂ ਘਰਾਂ ਵਿੱਚ ਪਾਣੀ ਹੀ ਨਹੀਂ ਆਉਂਦਾ ਹੈ ਅਤੇ ਪਾਣੀ ਆਉਂਦਾ ਵੀ ਹੈ ਤਾਂ ਇੰਨਾ ਗੰਦਾ ਪਾਣੀ ਆਉਂਦਾ ਹੈ ਜਿਹਦੇ ਨਾਲ ਲੋਕਾਂ ਦੀ ਸਰੀਰ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ ਦੂਸਰੀ ਸਮੱਸਿਆ ਹੈਗੀ ਹੈ ਹੈਗੀ ਕਿ ਡੋਕਟਰ ਹਸਪਤਾਲ ਆ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਲੋਕ ਜਿਹੜੇ ਗਰੀਬ ਲੋਕ ਹੁੰਦੇ ਹੈ ਉਹ ਜਾਣਾ ਕਹਿੰਦੇ ਹਨ ਕਿ ਸਾਨੂੰ ਜਿਹੜੇ ਵੱਡੇ ਵੱਡੇ ਡੋਕਟਰ ਆ ਉਹਨਾਂ ਦਾ ਉੱਥੇ ਸਾਨੂੰ ਚੰਗੀ ਤਰ੍ਹਾਂ ਇਲਾਜ ਮਿਲ ਸਕੇਗਾ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਹੈ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਸਮੇਂ ਸਿਰ ਨਹੀਂ ਆਉਂਦੇ ਹਨ ਅਤੇ ਜਿਹੜੇ ਉਹਨਾਂ ਦੀਆਂ ਮਸ਼ੀਨਾਂ ਵੀ ਹਨ ਉਹ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰਦੀਆਂ ਹਨ ਇਸ ਕਰਕੇ ਜਿਹੜੇ ਗਰੀਬ ਲੋਕਾਂ ਨੂੰ ਵੀ ਉੱਥੇ ਵੀ ਜਾ ਕੇ ਵੀ ਪੈਸਾ ਹੀ ਖਰਚਣਾ ਪੈਂਦਾ ਹੈ ਤੀਸਰੀ ਸਮੱਸਿਆ ਜਿਹੜੀ ਸਭ ਤੋਂ ਵੱਡੀ ਆਉਂਦੀ ਹੈਗੀ ਹੈ ਉਹ ਹੈਗੀ ਹੈ ਯਾਤਾਯਾਤ ਦੀ ਸਮੱਸਿਆ ਯਾਤਾਯਾਤ ਜਿੱਦਾਂ ਕਿ ਅੱਜ ਕੱਲ੍ਹ ਇੰਨੀ ਕੁ ਜ਼ਿਆਦਾ ਪ ਯਾਤਾਯਾਤ ਵੱਧ ਚੁੱਕਾ ਹੈ ਜਾਂ ਕਈ ਵਾਰੀ ਹੁੰਦਾ ਹੈ ਕਿ ਵੱਡੀਆਂ ਗੱਡੀਆਂ ਇੰਨੀਆਂ ਕੁ ਜ਼ਿਆਦਾ ਹਨ ਕਿ ਲੋਕ ਟਾਈਮ ਸ ਸਮੇਂ ਸਿਰ ਆਪਣੇ ਪਹੁੰਚ ਹੀ ਨਹੀਂ ਪਾਉਂਦੇ ਹਨ ਜਿੱਥੇ ਉਹਨਾਂ ਨੇ ਇੱਥੇ ਜਾਣਾ ਹੁੰਦਾ ਹੈ ਕਈ ਵਾਰੀ ਐਂਬੂਲੈਂਸਾਂ ਵਗੈਰਾ ਫਸ ਜਾਂਦੀਆਂ ਹਨ ਜਿਨ੍ਹਾਂ ਨੂੰ ਕਈ ਵਾਰੀ ਤਾਂ ਇਹ ਵੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਕਿ ਜਿਹੜੀਆਂ ਐਂਬੂਲੈਂਫਾਂ ਫਸੀਆਂ ਹੁੰਦੀਆਂ ਹਨ ਉਹਨਾਂ ਦੇ ਨਾਲ ਉੱਥੇ ਮਰੀਜ਼ ਪਿਆ ਦਮ ਹੀ ਤੋੜ ਦਿੰਦਾ ਹੈ ਪਰ ਉਹਨਾਂ ਨੂੰ ਚੰਗੀ ਤਰ੍ਹਾਂ ਉੱਥੇ ਉਸ ਹਸਪਤਾਲ ਤੱਕ ਪਹੁੰਚਣ ਨੂੰ ਮਿਲਦਾ ਹੀ ਨਹੀਂ ਹੁੰਦੇ ਹਨ ਚੌਥੀ ਸਮੱਸਿਆ ਜੋ ਆਮ ਸਰਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਐਸੀ ਦੇਖਣ ਨੂੰ ਮਿਲਦੀ ਹੈ ਜਿਵੇਂ ਹੈਗੀ ਹੈ ਕਿ ਪੋਲਿਊਸ਼ਨ ਇੱਥੇ ਜ਼ਿ ਇੱਥੇ ਇੰਨਾ ਕੁ ਜ਼ਿਆਦਾ ਧੂੰਆਂ ਇੰਨੇੇ ਕੁ ਜ਼ਿਆਦਾ ਗੱਡੀਆਂ ਦਾ ਵੱਧ ਚੁੱਕਾ ਹੈ ਜਿਹਦੇ ਅੰਦਰ ਜਿਹਦੇ ਨਾਲ ਆਮ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ